ਪਹਿਲਾਂ ਪਹਿਲ ਸੁਣਨ ਦੇ ਵਿੱਚ ਆਉਂਦਾ ਹੁੰਦਾ ਸੀਗਾ ਕਿ ਉਸਨੇ ਰਿਸ਼ਵਤ ਲੈ ਕੇ ਇੰਨੇ ਪੈਸੇ ਲੈ ਲਏ ਇੰਨੇ ਪੈਸੇ ਲੈ ਲਏ ਪਰ ਅੱਜ ਕੱਲ ਕਿ ਮੀਡੀਆ ਦਾ ਜ਼ਮਾਨਾ ਹੈਗਾ ਅਤੇ ਕੋਈ ਵੀ ਇਸ ਰਿਸ਼ਵਤ ਨੂੰ ਨਹੀਂ ਲੈ ਸਕਦਾ ਜਾਂ ਸਰਕਾਰ ਨੇ ਵੀ ਬਹੁਤ ਸਖਤ ਰੂਲ ਕੀਤੇ ਹਨ ਕਿ ਕੋਈ ਵੀ ਰਿਸ਼ਵਤ ਲੈ ਨਹੀਂ ਸਕਦਾ ਨਾ ਦੇ ਸਕਦਾ ਲੈਣ ਵਾਲਾ ਵੀ ਉੱਨਾ ਜਿੰਮੇਵਾਰ ਹੋਵੇਗਾ ਦੇਣ ਵਾਲਾ ਵੀ ਉੱਨਾ ਜਿੰਮੇਵਾਰ ਹੋ ਗਿਆ ਇਸ ਕਰਕੇ ਰਿਸ਼ਵਤ ਘਟੀ ਹੈ ਅਤੇ ਜਿਸ ਨਾਲ ਕਿ ਸਾਡੇ ਮੌਜੂਦਾ ਮਤਲਬ ਸਾਡੇ ਸਮਾਜ ਦੇ ਵਿੱਚ ਬਹੁਤ ਸੁਧਾਰ ਹੋਇਆ ਹੈ